ਇੱਕ ਵਾਰ ਦੀ ਗੱਲ ਹੈ ਕਿ ਮਹਾਰਾਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਤੋਂ ਆਉਂਦੇ ਹ ਸਮੇਂ ਰੋਪੜ ਤੋਂ ਨਿਕਲ ਰਹੇ ਸੀ ਕਿ ਮਹਾਰਾਜ ਜੀ ਨੇ ਪੁੱਛਿਆ ਕਿ ਮੈਨੂੰ ਮੈਂ ਚੰਡੀਗੜ੍ਹ ਜਾਂ ਕੁਰਾਲੀ ਦੇ ਰਸਤੇ ਜਾਣਾ ਅਤੇ ਤੁਸੀਂ ਮੈਨੂੰ ਰਸਤਾ ਦੱਸੋ ਕੋਲ ਬਲ਼ਦਾ ਹੋਇਆ ਭੱਠਾ ਦੇਖ ਕੇ ਮਜ਼ਦੂਰਾਂ ਨੇ ਮਹਾਰਾਜ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨਾਲ ਮਜ਼ਾਕ ਕੀਤਾ ਅਤੇ ਮਹਾਰਾਜ ਨੂੰ ਇਸ਼ਾਰਾ ਕੀਤਾ ਕਿ ਬਲਦਾ ਭੱਠਾ ਜਿੱਥੇ ਕਿ ਇੱਟਾਂ ਬਣਦੀਆਂ ਬਲਦੇ ਭੱਠੇ ਵੱਲ ਇਸ਼ਾਰਾ ਕੀਤਾ ਕਿ ਇਹ ਰਸਤਾ ਉਹ ਪਿੰਡ ਨੂੰ ਜਾਂ ਉਹ ਸ਼ਹਿਰ ਨੂੰ ਜਾਂਦਾ ਹੈ ਤੁਸੀਂ ਇੱਧਰੋਂ ਨਿਕਲ ਜੋ ਅਤੇ ਮਹਾਰਾਜ ਮੁਸਕਰਾ ਕੇ ਬੋਲੇ ਕਿ ਕੋਈ ਗੱਲ ਨਹੀਂ ਠੀਕ ਹੈ ਅਤੇ ਮਹਾਰਾਜ ਨੇ ਆਪਣੇ ਘੋੜੇ ਦੀ ਲਗਾਮ ਨੂੰ ਹੱਥ ਪਾ ਕੇ ਜਦੋਂ ਜੋਸ਼ ਵਿੱਚ ਆ ਕੇ ਘੋੜੇ ਨੂੰ ਤੋਰਿਆ ਅੱਗੇ ਤਾਂ ਮਹਾਰਾਜ ਦੇ ਘੋੜੇ ਨੇ ਉਸ ਭੱਠੇ ਦੇ ਉੱਪਰ ਪੌੜ ਮਾਰ ਕੇ ਭੱਠਾ ਪੂਰੇ ਦਾ ਪੂਰਾ ਠੰਡਾ ਕਰ ਦਿੱਤਾ ਵਾਹਿਗੁਰੂ ਭੱਠਾ ਪੂਰੇ ਦਾ ਪੂਰਾ ਠੰਡਾ ਕਰ ਦਿੱਤਾ ਅਤੇ ਜੋ ਮਜ਼ਦੂਰ ਜਿਹਨਾਂ ਨੇ ਮਜ਼ਾਕ ਕੀਤਾ ਸੀ ਮਹਾਰਾਜ ਦੇ ਨਾਲ ਤਾਂ ਉਹ ਆ ਕੇ ਮਹਾਰਾਜ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਹੋ ਗਏ ਕਿ ਮਹਾਰਾਜ ਸਾਤੋਂ ਗਲਤੀ ਹੋ ਗਈ ਸਾਨੂੰ ਬਖਸ਼ ਦਿਉ ਅਸੀਂ ਤੁਹਾਡੇ ਅੱਗੇ ਨਿਮਾਣੇ ਅਸੀਂ ਗਲਤੀ ਕਰ ਬੈਠੇ ਹਾਂ ਸਾਨੂੰ ਮਾਫ ਕਰ ਦਿਓ ਅਤੇ ਮਹਾਰਾਜ ਨੂੰ ਹੱਥ ਜੋੜ ਕੇ ਉਹਨਾਂ ਨੇ ਬੇਨਤੀ ਕੀਤੀ ਔਰ ਮਹਾਰਾਜ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਵੀ ਚਲੋ ਬਖਸ਼ਣਹਾਰ ਹੈ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਬਖਸ਼ਣਹਾਰ ਹੈ ਅਤੇ ਉਹਨਾਂ ਨੇ ਉਹਨਾਂ ਨੂੰ ਬਖਸ਼ ਦਿੱਤਾ ਅਤੇ ਅੱਗੇ ਜਾਣ ਦਾ ਰਸਤਾ ਪੁੱਛਿਆ ਤਾਂ ਉਹਨਾਂ ਨੇ ਨਾਲ ਦੇ ਨਾਲ ਦੇ ਕੰਮ ਕਰਨ ਵਾਲੇ ਇੱਕ ਬੰਦੇ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਰਸਤਾ ਦਿਖਾ ਕੇ ਆਓ ਸਾਈਡ ਤੋਂ ਹੋ ਕੇ ਮਹਾਰਾਜ ਉੱਥੇ ਤੋਂ ਫਿਰ ਨਿਕਲ ਗਏ ਜੋ ਕਿ ਇਹ ਗੁਰਦੁਆਰਾ ਸਾਹਿਬ ਸ਼੍ਰੀ ਭੱਠਾ ਸਾਹਿਬ ਹੈ ਜੋ ਕਿ ਰੋਪੜ ਦੇ ਵਿੱਚ ਸਥਿਤ ਹੈ ਤੁਸੀਂ ਆਓ ਅਤੇ ਦਰਸ਼ਨ ਕਰ ਸਕਦੇ ਹੋ